ਹਾਂ ਹੈਪੀ ਬੋਲਦਾ ਬਾਈ ਕਿਆ ਹਾਲ ਆ ਬਾਈ ਕੈਬ ਬੁੱਕ ਕਰੀ ਸੀ ਯਾਰ ਤੂੰ ਬੜੀ ਹਵੇਲੀ ਤੋਂ ਬੋਲਦਾ ਜਸਪ੍ਰੀਤ ਤੂੰ ਹਾਲੇ ਤੱਕ ਪਹੁੰਚਿਆ ਨਹੀਂ ਤੂੰ ਯਾਰ ਹੱਦ ਹੋ ਗਈ ਯਾਰ ਕੱਦੇ ਉਡੀਕਦੇ ਦੋ ਘੰਟੇ ਹੋ ਗਏ ਸਾਨੂੰ ਕ੍ਰਿਸ਼ਨਾ ਮੰਦਰ ਕੋਲ ਖੜ੍ਹੇ ਨੂੰ ਅਤੇ ਤੀਏ ਦਾ ਨਾ ਤੂੰ ਫੋਨ ਚੱਕਦਾ ਜੇ ਆਉਣਾ ਹੈ ਤਾਂ ਦੱਸਦੇ ਨਹੀਂ ਆਉਣਾ ਤਾਂ ਦੱਸਦੇ ਹੋਰ ਬੁੱਕ ਕਰਾਂ ਕੈਬ